ਕਾਨੂੰਨ ਨਾਲ ਨਜਿੱਠਣ ਲਈ ਕਾਨੂੰਨੀ ਤੌਰ 'ਤੇ ਹੀ ਤਰੀਕਾ ਵਰਤਣਾ ਸਹੀ ਰਹਿੰਦਾ ਹੈ ਕਿਉਂਕਿ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਅਸੀਂ ਸਹੀ ਕੰ ਸਹੀ ਰਹਿੰਦੇ ਹਾਂ ਅਤੇ ਕੋਈ ਗਲਤ ਕਦਮ ਨਹੀਂ ਚੁੱਕਦੇ ਅਤੇ ਕਾਨੂੰਨ ਦੀ ਨਿਗ੍ਹਾ ਵਿੱਚ ਵੀ ਸਹੀ ਰਹਿੰਦੇ ਹਾਂ ਕਾਨੂੰਨੀ ਤੌਰ 'ਤੇ ਅਸੀਂ ਬਹੁਤ ਸਾਨੂੰ ਬਹੁਤ ਹੱਕ ਹਨ ਅਤੇ ਅਸੀਂ ਕਿਸੇ ਵੀ ਮੁੱਦੇ ਉਤੇ ਖੁੱਲ੍ਹ ਕੇ ਬੋਲ ਸਕਦੇ ਹਾਂ ਤਾਂ ਜ਼ਮੀਨੀ ਝਗੜਿਆਂ ਅਤੇ ਪਰਿਵਾਰਿਕ ਮਾਮਲਿਆਂ ਨੂੰ ਜਦ ਤੱਕ ਹੋਵੇ ਤਾਂ ਉਸਨੂੰ ਆਪਣੇ ਪਿੰਡ ਲੈਵਲ ਤੱਕ ਹੀ ਰੱਖਣਾ ਚਾਹੀਦਾ ਹੈ ਸਰਪੰਚ ਜਾਂ ਉਹ ਥਾਣੇਦਾਰ ਤੱਕ ਹੀ ਮਸਲੇ ਨੂੰ ਨਿਬੇੜ ਲੈਣਾ ਚਾਹੀਦਾ ਹੈ ਪਰ ਜੇ ਗੱਲ ਕੋਰਟਾਂ ਕਚਹਿਰੀਆਂ ਤੱਕ ਜਾਂਦੀ ਹੈ ਤਾਂ ਵਕੀਲ ਦਾ ਸਹਾਰਾ ਲੈਣਾ ਚਾਹੀਦਾ ਹੈ ਅਤੇ ਨਾ ਹੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਚਾਹੀਦਾ ਹੈ ਕਰਜ਼ੇ ਆਦਿ ਵਰਗੇ ਕਾਨੂੰਨੀ ਮੁੱਦਿਆਂ ਨੂੰ ਸੁਲਝਾਉਣ ਲਈ ਵੀ ਆਪਾਂ ਨੂੰ ਵਕੀਲ ਜਾਂ ਥਾਣੇਦਾਰ ਜਾਂ ਪੁਲਿਸ ਮੁਲਾਜ਼ਮਾਂ ਦਾ ਹੀ ਸਹਾਰਾ ਲੈਣਾ ਚਾਹੀਦਾ ਹੈ ਕਾਨੂੰਨ ਨੂੰ ਆਪਣੇ ਵਿੱਚ ਹੱਥ ਹੱਥ ਵਿੱਚ ਨਾ ਲੈ ਕੇ ਸਾਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਹੈ